ਸਾਡੇ ਖੇਤਰ ਵਿੱਚ ਕੀੜੇ ਵਪਾਰਕ ਗਤੀਵਿਧੀਆਂ ਲਈ ਵਰਤੇ ਜਾਂਦੇ ਹਨ ਸਾਡੇ ਖੇਤਰ ਵਿੱਚ ਪਾਣੀ ਝਰਨੇ ਨਦੀਆਂ ਤਲਾਬ ਆਦਿ ਕੁਦਰਤੀ ਸਰੋਤ ਹਨ ਬਾਕੀ ਖੇਤੀਬਾੜੀ ਖੇਤ ਜੋ ਕਿ ਅਨਾਜ ਪੈਦਾ ਕਰਦੇ ਹਨ ਪਸ਼ੂ ਵੀ ਦੁੱਧ ਵਾਸਤੇ ਜੀਵ ਰੂਪੀ ਸਰੋਤ ਕੁਦਰਤੀ ਸਰੋਤ ਹਨ ਇਸ ਲਈ ਇਹਨਾਂ ਦਾ ਬਾਰਕ ਗਤੀਵਿਧੀਆਂ ਲਈ ਵਰਤਨ ਲਈ ਕਾਫੀ ਸਰੋਤ ਹੈ ਇਸ ਕਰਕੇ ਕੁਦਰਤੀ ਸਰੋਤਾ ਨਾਲ ਹੀ ਗੁਜ਼ਾਰਾ ਹੋ ਸਕਦਾ ਹੈ ਧੰਨਵਾਦ ਜੀ